ਅ ਮੈਂ ਅੱਜ ਨਾ ਫਲਿਪਕਾਟ ਤੋਂ ਆਪਣੇ ਲਈ ਇਕ ਡਰੈੱਸ ਮੰਗਵਾਈ ਜਿਹੜੀ ਡਰੈੱਸ ਸੀਗੀ ਮੈਂ ਫ਼ਰਾਕ ਸੂਟ ਮੰਗਾਇਆ ਸੀ ਮੈਂ ਤਾਂ ਸੋਚਿਆ ਵੀ ਸਿਰਫ ਫ਼ਰਾਕ ਸੂਟ ਹੈ ਫ਼ਰਾਕ ਸੂਟ ਦੇ ਨਾਲ ਨਾਲ ਉਨੇਂ ਪੈਸੇ 'ਚ ਜਿੰਨਾ ਇੱਕਲਾ ਇੱਕ ਫ਼ਰਾਕ ਸੂਟ ਆਉਣਾ ਸੀ ਨਾਲੇ ਮੈਨੂੰ ਪਜ਼ਾਮੀ ਨਾਲੇ ਚੁੰਨੀ ਇੰਨਾ ਸੋਹਣਾ ਉਏਂ ਕੱਪੜਾ ਤਾਂ ਬਾਈ ਹੱਥ ਲਾਇਆ ਹੀ ਮੈਲਾ ਹੁੰਦਾ ਹੈ ਇੰਨਾ ਸੋਹਣਾ ਰੰਗ ਚਿੱਟਾ ਦੁੱਧ ਵਰਗਾ ਰੰਗ ਦੇਖੋ ਕਹਿਣ ਨੂੰ ਹੀ ਹੁੰਦਾ ਵੀ ਆਨਲਾਈਨ ਆਨਲਾਈਨ ਸ਼ੌਪਿੰਗ ਮਗਰ ਬੜਾ ਵਧੀਆ ਆਇਆ ਭਈ ਮੈਂ ਪਾ ਕੇ ਜਦ ਗਈ ਹਾਂ ਮੇਰੀ ਆਂਢਣ ਗਵਾਢਣਾਂ ਸਾਰੀਆ ਮੇਰੀ ਤਾਰੀਫ ਕਰਨ ਹੋਰ ਕੀ ਚਾਹੀਦਾ ਆ ਮੈਂ ਤਾਂ ਅੱਗੇ ਤੋਂ ਇਹਨਾਂ ਤੋਂ ਹੀ ਸਾਰਾ ਸਮਾਨ ਮੰਗਵਾਇਆ ਕਰਾਂਗੀ ਕੱਪੜੇ ਲੱਤੇ ਆਪਣੇ ਹਾਂ ਮਗਰ ਇੱਕ ਗੱਲ ਹੋਰ ਆ ਆਹ ਫੁੱਲ ਬੂਟੀਆਂ ਮੈਂ ਤਾਂ ਸੋਚਿਆ ਹੀ ਨਹੀਂ ਸੀਗੀਆਂ ਉਮੀਦੋਂ ਵੱਧ ਆ ਗਿਆ ਵਧੀਆ ਲੱਗਦਾ ਸਮਾਨ ਬਟਨ ਲੱਗੇ ਹੋਏ ਦੇਖੋ ਤਾਂ ਚਮਕੀਲ ਬਟਨ ਆ ਉੱਤੇ ਜਿਹੜੇ ਲੱਗੇ ਹੋਏ ਨੇ ਹੋਰ ਤਾਂ ਹੋਰ ਰੇਟ ਬਾਈ ਰੇਟ ਦੇਖੋ ਉਨੇ ਰੇਟ ਦੇ ਵਿੱਚ ਕੀ ਕੁ੍ਝ ਤੁਹਾਨੂੰ ਮਿਲੂਗਾ ਨਹੀਂ ਤਾਂ ਇੱਕ ਕੁੜਤੀ ਜਿਹੀ ਅੱਜ ਕੱਲ੍ਹ ਥਮਾ ਦਿੰਦੇ ਆ ਹੈ ਰੇਟ ਤਾਂ ਬੜਾ ਵਾਜ਼ਿਬ ਆ ਮ ਇੰਨੇ ਰੇਟ ਨੂੰ ਤਾਂ ਲੈ ਕੀ ਆਉਣਾ ਹਾਂ ਇਕੱਲੀ ਇੱਕ ਕੁੜਤੀ ਇਹ ਪੂਰਾ ਦਾ ਪੂਰਾ ਸੈੱਟ ਪਾਇਆ ਹੈ ਇਹਨਾਂ ਨੇ ਸਾਨੂੰ ਬਈ ਅੱਗੇ ਤੋਂ ਮੈਂ ਇਹਨਾਂ ਤੋ ਹੀ ਲੈ ਲਿਆ ਕਰਨਾ ਸਮਾਨ ਸਾਰਾ ਹੋਰ ਕੀ ਇਵੇਂ ਨਿੱਕੀਆਂ ਨਿੱਕੀਆਂ ਝੱਗੀਆ ਦੇ ਇਹ ਸੌ ਸੌ ਰੁਪਏ ਲਾਈ ਜਾਂਦੇ ਆ ਬਈ ਇਹ ਦੇਖ ਦੋ ਸੌ ਦੇ ਵਿੱਚ ਮੈਨੂੰ ਪੂਰਾ ਸੂਟ ਮਿਲ ਗਿਆ ਮੈਂ ਤਾਂ ਵਾਵਾ ਖੁਸ਼ ਹਾਂ